ਹੈਲੋ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਤੁਸੀਂ ਮੈਦਾਨ ਸ਼ੋਰੂਮ ਤੋਂ ਬੋਲਦੇ ਪਏ ਹੋ ਹਾਂਜੀ ਵੀਰੇ ਅਸੀਂ ਨਾ ਮੈਂ ਨਾ ਦਿਵਾਲੀ ਵਾਸਤੇ ਚੱਪਲਾਂ ਅਤੇ ਬੂਟ ਅਤੇ ਸੈਂਡਲ ਦਾ ਜੋੜਾ ਲੈ ਕੇ ਗਈ ਸੀ ਹਾਂਜੀ ਉਹਦੀ ਕੁਆਲਿਟੀ ਮੈਨੂੰ ਬਹੁਤ ਵਧੀਆ ਲੱਗੀ ਅਤੇ ਤੁਸੀਂ ਮੈਨੂੰ ਉਹਦੀ ਕੇਅਰ ਬਾਰੇ ਦੱਸੋਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਵੀਰੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੇ ਇੱਕ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਇਕ ਵੀਰੇ ਵੀ ਮੰਨ ਲਾ ਜਿਵੇਂ ਵੀ ਆਪਾਂ ਲੈ ਕੇ ਗਏ ਹੈਗੇ ਹਾਂ ਅਤੇ ਉਹਨਾਂ ਦੇ ਵਿੱਚ ਕੋਈ ਖਰਾਬ ਹੁੰਦਾ ਹੈ ਨਾ ਕੀ ਵੀ ਜੋੜਾ ਤਾਂ ਉਹਨਾਂ ਦੇ ਵਿੱਚ ਤੁਸੀਂ ਮੈਨੂੰ ਚੇਂਜ ਕਰਕੇ ਦਵੋਂਗੇ ਜਾਂ ਵੀ ਪੈਸੇ ਵਾਪਿਸ ਦਿਓਗੇ ਹਾਂਜੀ ਹਾਂਜੀ ਹਾਂਜੀ

ਠੀਕ ਹੈ ਜੀ ਜੇ ਮੈਨੂੰ ਹੋਰ ਵੀ ਕੁਆਲਿਟੀ ਚੰਗੀ ਲੱਗੀ ਤਾਂ ਮੈਂ ਹੋਰ ਵੀ ਲੈ ਕੇ ਜਾਵਾਂਗੀ ਵੀਰੇ ਹਾਂਜੀ ਹਾਂਜੀ ਹਾਂਜੀ ਅਤੇ ਹੋਰ ਕੀ ਕੀ ਆਫਰ ਚੱਲੀ ਜਾਂਦੇ ਵੀਰੇ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਹਾਂਜੀ ਵੈਸੇ ਤਾਂ ਵੀਰੇ ਤੁਹਾਡੇ ਬਹੁਤ ਵਧੀਆ ਪ੍ਰੋ ਪ੍ਰੋਜੈਕਟ ਹੈਗੇ ਇਹ ਪ੍ਰੋ ਪ੍ਰੋਜੈਕਟ ਮੈਨੇ ਕਿਹਾ ਚੱਲੋ ਠੀਕ ਹੈ ਵੀਰ ਜੀ ਧੰਨਵਾਦ